ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਤੁਹਾਡੀ ਕਲਾਸ 'ਚ ਮੇਰਾ ਬੇਟਾ ਪੜ੍ਹਦਾ ਹੋਣਾ ਸਾਹਿਲ ਮਦਾਨ ਹਾਂਜੀ ਉਹ ਦੀ ਨਾ ਤਬੀਅਤ ਥੋੜ੍ਹੇ ਪਿਛਲੇ ਦਿਨਾਂ ਤੋਂ ਨਾ ਠੀਕ ਨਹੀਂ ਆ ਅਤੇ ਡਾਕਟਰ ਕੋਲ ਚੈੱਕ ਕਰਵਾਇਆ ਉਹਨੇ ਕਿਹਾ ਪੇਟ 'ਚ ਇਨਫੈਕਸ਼ਨ ਆ ਇਸ ਕਰਕੇ ਸਾਨੂੰ ਨਾ ਹਾਂਜੀ ਅਤੇ ਡਾਕਟਰ ਨੇ ਕਿਹਾ ਤਿੰਨ ਚਾਰ ਦਿਨ ਰੈਸਟ ਕਰੇ ਅਤੇ ਉਸ ਲਈ ਨਹੀਂ ਨਹੀਂ ਪੇਟ 'ਚ ਇਨਫੈਕਸ਼ਨ ਆਈ ਆ ਹਾਂਜੀ ਤਾਂ ਫਿਰ ਦਵਾਈ ਦਿੱਤੀ ਆ ਉਹਨੇ ਤਿੰਨ ਚਾਰ ਦਿਨ ਰੈਸਟ ਦੱਸੀ ਆ ਫਿਰ ਉਹ ਸਕੂਲ ਤਾਂ ਆਇਆ ਨਹੀਂ ਜਾਣਾ ਉਹਦੇ ਕੋਲ ਤਾਂ ਸਾਨੂੰ ਛੁੱਟੀ ਚਾਹੀਦੀ ਸੀ ਤਿੰਨ ਚਾਰ ਦਿਨ ਦੀ ਹਾਂਜੀ ਹਾਂਜੀ ਉਹ ਕਹਿੰਦਾ ਦੋ ਦਿਨ ਰੈਸਟ ਕਰੇ ਦਵਾਈ ਖਾਵੇ ਫਿਰ ਸਾਨੂੰ ਦੁਬਾਰਾ ਚੈੱਕ ਕਰਾਵੇ ਫਿਰ ਦੁਬਾਰਾ ਚੈੱਕ ਕਰਵਾਉਣ ਲਈ ਵੀ ਜਾਣਾ ਪੈਣਾ ਵਾ ਤਾਂ ਅਸੀਂ ਕਿਹਾ ਪ੍ਰੋਪਰ ਠੀਕ ਹੋ ਹੀ ਜਾਵੇ ਫਿਰ ਹੀ ਸਕੂਲ ਭੇਜੀਏ ਫਿਰ ਹਾਂਜੀ ਹਾਂਜੀ ਪੜ੍ਹਾਈ ਤਾਂ ਅਸੀਂ ਘਰ ਪੜ੍ਹਾਈ ਜਾਵਾਂਗੇ ਉਹਨੂੰ ਰਵੀਜਨ ਕਰਾ ਦਾਂਗੇ ਸਾਰੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਓਕੇ ਸਰ